ਸੋਸ਼ਲ ਮੀਡੀਆ ਨੇ ਸਾਨੂੰ ਬਹੁਤ ਸੌਖੇ ਤਰੀਕੇ ਨਾਲ ਕਲਾ ਸਿਖਾਈ ਹੈ ਅਸੀਂ ਸੋਸ਼ਲ ਮੀਡੀਆ ਤੋਂ ਵੇਖ ਕੇ ਪੁਰਾਣੇ ਪਏ ਸਮਾਨ ਤੋਂ ਨਵੀਆਂ ਨਵੀਆਂ ਚੀਜ਼ਾਂ ਬਣਾ ਲੈਂਦੇ ਹਾਂ ਜਿਵੇਂ ਕਿ ਸਾਡੀਆਂ ਬੋਤਲਾਂ ਖਾਲੀ ਹੁੰਦੀਆਂ ਨੇ ਫਿਰ ਅਸੀਂ ਉਹਨਾਂ ਨੂੰ ਕੱਟ ਕੇ ਅਤੇ ਵਿੱਚ ਮਿੱਟੀ ਭਰ ਕੇ ਫੁੱਲ ਲਗਾ ਲਈਦੇ ਨੇ ਬਾਹਰ ਉਹਨਾਂ ਦੇ ਸੋਹਣਾ ਸੋਹਣਾ ਪੇਂਟ ਕਰਕੇ ਅਤੇ ਘਰ ਦੀ ਸਜਾਵਟ ਹੋਰ ਵੀ ਬਣਾ ਲਈਦੀ ਹੈ ਇਸ ਤੋਂ ਵੇਖ ਕੇ ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾ ਲੈਂਦੇ ਹਾਂ ਜੀ ਜਿਹੜੇ ਕਿ ਸਾਡੇ ਘਰ ਨੂੰ ਹੋਰ ਵੀ ਸਜਾ ਦਿੰਦੇ ਹਨ ਬਾਕੀ ਅਸੀਂ ਘਰ ਬਣਾਇਆ ਉਹਦੇ ਵਿੱਚੋਂ ਪੁਰਾਣੇ ਫਿਟਿੰਗ ਦੇ ਡੱਬੇ ਨਿਕਲੇ ਉਹਨਾਂ ਵਿੱਚ ਵੀ ਅਸੀਂ ਮਿੱਟੀ ਭਰ ਕੇ ਅਤੇ ਉਹਨਾਂ ਦੇ ਵੀ ਗਮਲੇ ਬਣਾ ਲਏ ਜਿਹੜਾ ਕੋਈ ਆਉਂਦਾ ਵੇਖਦਾ ਹੈ ਕਹਿੰਦਾ ਕਿੰਨੇ ਸੋਹਣੇ ਸੋਹਣੇ ਘਰ ਵਿੱਚ ਗਮਲੇ ਬਣਾ ਕੇ ਰੱਖੇ ਹੋਏ ਨੇ ਤੁਸੀਂ ਆਪੇ ਹੀ ਬਣਾਏ ਨੇ ਅਸੀਂ ਕਹਿਦੇ ਹਾਂ ਹਾਂਜੀ ਅਸੀਂ ਤਾਂ ਆਪੇ ਹੀ ਬਣਾ ਲੈਂਦੇ ਹਾਂ